ਹਾਂਜੀ ਆਪਣਾ ਕਿਹਦਾ ਕਿੱਥੋਂ ਬੋਲਦੇ ਆ ਜੀ ਅੱਛਾ ਜੀ ਮੈਂ ਸੇਵਾ ਜੀ ਬਸ ਜੀ ਨਾ ਇੱਥੋਂ ਲੰਘੇ ਜਾ ਰਹੇ ਸੀ ਸਾਨੂੰ ਕਿਸੇ ਨੇ ਦੱਸਿਆ ਸੀ ਵੀ ਇੱਥੇ ਢਾਬੇ ਦੇ ਵੀ ਖਾਣਾ ਖੁਣਾ ਚੰਗਾ ਮਿਲਦਾ ਜੀ ਅਤੇ ਸ਼ੇਰੇ ਪੰਜਾਬ ਹੀ ਆ ਨਾ ਜੀ ਹਾਂਜੀ ਹਾਂਜੀ ਉਹ ਸਾਨੂੰ ਦੱਸਿਆ ਸੀ ਕਿਸੇ ਨੇ ਵੀ ਅਸੀਂ ਜਿੱਦਾਂ ਗੱਡੀਆਂ ਸਾਡੇ ਕੋਲ ਟ੍ਰਾਂਸਪੋਰਟ ਆ ਜੀ ਲੰਘਦੇ ਕਰਦੇ ਰਹਿੰਦੇ ਇਥੋਂ ਜੀ ਹਾਂਜੀ ਪਹਿਲਾਂ ਅਸੀਂ ਦੂਜੇ ਢਾਬਿਆਂ 'ਚ ਜਾਂਦੇ ਸੀਗੇ ਜੀ ਅਤੇ ਇੱਥੇ ਖਾਣਾ ਖੁਣਾ ਚੰਗਾ ਨਹੀਂ ਲੱਗਿਆ ਸਾਨੂੰ ਕਈ ਦਿਨ ਦਿਨਾਂ ਤੋਂ ਉਹ ਦੂਜਿਆਂ ਨੇ ਦੱਸਿਆ ਇੱਥੇ ਰੈਸਪੀ ਦੇ ਵਿੱਚ ਚੰਗੀਆਂ ਚੀਜ਼ਾਂ ਨੇ ਵਧੀਆ ਜੀ ਮੈਂ ਕਿਹਾ ਫਿਰ ਗੇੜਾ ਮਾਰ ਕੇ ਤੁਹਾਡੇ ਕੋਲ ਆਵਾਂਗੇ ਜੀ ਹਾਂਜੀ ਅੱਛਾ ਜੀ

ਹਾਂਜੀ ਉਸਨੇ ਹਾਂਜੀ ਕੀ ਕੀ ਚੀਜ਼ਾਂ ਮਿਲ ਜਾਂਦੀਆਂ ਆਪਣੇ ਜੀ ਹਾਂਜੀ ਹਾਂਜੀ ਹਾਂਜੀ ਲੱਸੀ ਵੀ ਮਿਲਦੀ ਹੈ ਅੱਛਾ ਜੀ ਲੱਸੀ ਵੀ ਮਿਲਦੀ ਹੈ ਲੱਸੀ ਦੇ ਵੀ ਸ਼ੌਕੀਨ ਆ ਮੈਡਮ ਜੀ ਤਾਂ ਹੀ ਪੁੱਛਿਆ ਜੀ ਤੁਹਾਨੂੰ ਮੈਂ ਲੱਸੀ ਸਾਡੇ ਮਿਲ ਜਾਂਦੀ ਕਈਆਂ ਹੋਟਲਾਂ 'ਤੇ ਮਿਲਦੀ ਨਹੀਂ ਨਾ ਜੀ ਹਾਂਜੀ ਫਿਰ ਕਿੱਦਾਂ ਐਂ ਨਾ ਸਾਨੂੰ ਕਿਸੇ ਨੇ ਦੱਸਿਆ ਤੁਹਾਡੇ ਚਾਹ ਵੀ ਬਹੁਤ ਮਸ਼ਹੂਰ ਹੈ ਜੀ ਗੁੜ ਵਾਲੀ ਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਮੈਡਮ ਕੀ ਰੇਟ ਰੁਟ ਸਹੀ ਹੈ ਮੈਡਮ ਤੁਹਾਡਾ ਜੀ ਥਾਲੀ ਥੁਲੀ ਦਾ ਕੀ ਰੇਟ ਲਾਉਂਦੇ ਮੈਡਮ ਤੁਸੀਂ ਜੀ ਮੰਨ ਲਓ ਇੱਕ ਬੰਦੇ ਨੇ ਖਾਨਾ ਖਾਣਾ ਹੋਵੇ ਕੀ ਰੇਟ ਲਾਉਂਦੇ ਆ ਜੀ ਰੇਟ ਤਾਂ ਬਹੁਤ ਥੋੜ੍ਹਾ ਤੁਹਾਡਾ ਠੀਕ ਹੈ ਜੀ ਫਿਰ ਖਾਣਾ ਉਸ ਹਿਸਾਬ ਨਾਲ ਵਧੀਆ ਦਿੰਨੇ ਜੀ ਰੇਟ ਤਾਂ ਥੋੜ੍ਹਾ ਜੀ ਤੁਹਾਡਾ ਖਾਣ ਪੀਣ ਦਾ ਕੋਈ ਗਲ ਨਹੀਂ ਹੁੰਦੀ ਖਾਣਾ ਚੀਜ਼ ਚੰਗੀ ਮਿਲੇ ਰੋਟੀ ਪਿਛੇ ਤੁਰਿਆ ਫਿਰਦਾ ਬੰਦਾ ਖਾਣਾ ਵਧੀਆ ਮਿਲੇ ਜੀ ਚਲੋ ਅਸੀਂ ਜਦੋਂ ਤੁਹਾਨੂੰ ਜ਼ਰੂਰ ਤੁਹਾਡੇ ਇਥੋਂ ਹੋ ਕੇ ਜਾਵਾਂਗੇ ਜੀ ਧੰਨਵਾਦ ਜੀ